ਸਾਡੇ ਪੰਜਾਬ ਦੇ ਵਿੱਚ ਸਿਹਤ ਨਾਲ ਜੁੜੀਆਂ ਬਹੁਤ ਸਾਰੀਆਂ ਮੁਸ਼ਕਿਲਾਂ ਆ ਰਹੀਆਂ ਜਿਵੇਂ ਅੱਜ ਕੱਲ੍ਹ ਮੋਟਾਪਾ ਆ ਕੈਂਸਰ ਆ ਅਤੇ ਸਕਿੰਨ ਦੇ ਨਾਲ ਸੰਬੰਧਿਤ ਬਿਮਾਰੀਆਂ ਆ ਇਹ ਕਾਫੀ ਹਨ ਅਤੇ ਇਹਨਾਂ ਦੇ ਨਾਲ ਲੋਕ ਬਹੁਤ ਗ੍ਰਸਤ ਹਨ ਅਤੇ ਬਹੁਤ ਪਰੇਸ਼ਾਨ ਹਨ ਅੱਜ ਕੱਲ੍ਹ ਜਿੱਦਾਂ ਦਾ ਸਾਡਾ ਖਾਣਾ ਆ ਉਹਦੇ ਕਰਕੇ ਸਾਨੂੰ ਕਈ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਆ ਜਿਵੇਂ ਹੁਣ ਕ ਹੈਵੀ ਖਾਣਾ ਖਾ ਕੇ ਬਾਹਰਲਾ ਜੰਕ ਫੂਡ ਖਾਣਾ ਖਾ ਕੇ ਜ਼ਿਆਦਾਤਰ ਲੋਕਾਂ ਨੂੰ ਲੀਵਰ ਦਾ ਡਾਈਜੇਸ਼ਨ ਦੇ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀਆਂ ਪਈਆਂ ਹੈ ਅਤੇ ਲੋਕ ਕਾਫੀ ਜਦੋਂ ਤੁਸੀਂ ਹੋਸਪਿਟਲਾਂ 'ਚ ਜਾਂਦੇ ਹਾਂ ਤੁਸੀਂ ਦੇਖਦੇ ਹੋਣੇ ਆ ਹੋਸਪਿਟਲ ਭਰੇ ਪਏ ਨੇ ਇਸ ਕਰਕੇ ਸਾਡੇ ਪੰਜਾਬ ਦੇ ਵਿੱਚ ਅੱਗੇ ਨਾਲੋਂ ਹਵਾ ਕਾਫੀ ਪ੍ਰਦੂਸ਼ਿਤ ਹੋ ਰਹੀ ਆ ਉਹਦੇ ਨਾਲ ਵੀ ਸਾਹ ਲੈਣ ਦੇ ਵਿੱਚ ਦਿੱਕਤ ਇਸ ਤਰ੍ਹਾਂ ਦੀਆਂ ਬਿਮਾਰੀਆਂ ਆ ਰਹੀਆਂ ਹਨ